ਹਾਂਜੀ ਸਰ ਕਿਆ ਸਤਿ ਸ਼੍ਰੀ ਅਕਾਲ ਸਰ ਮੇਰੀ ਗੱਲ ਕਿਹੜੀ ਸੁਰਜੀਤ ਸਿੰਘ ਜੀ ਨਾਲ ਹੋ ਰਹੀ ਹੈ ਜਿਹੜੇ ਕਿ ਐੱਚ ਆਰ ਓ ਹੈਗੇ ਨੇ ਹਾਂਜੀ ਹਾਂਜੀ ਸਰ ਤੁਸੀਂ ਕੁਝ ਦਿਨ ਪਹਿਲਾਂ ਸਾਡੇ ਕੈਂਪਸ 'ਚ ਆਏ ਸੀਗੇ ਨਾ ਜਿਹਦੇ ਵਿੱਚ ਸਾਡਾ ਨਾਂ ਲੈ ਰਹੇ ਸੀ ਛੋਟ ਲਿਸਟ ਦੇ ਵਿੱਚੋਂ ਸਰ ਉਹਦੇ ਵਿੱਚ ਨਾ ਮੇਰਾ ਨਾਮ ਵੀ ਸਰ ਤੁਸੀਂ ਲੈ ਗਏ ਸੀ ਮੇਰੀ ਨਾ ਸੈਲਰੀ ਪੈਕਜ ਵੀ ਮੈਨੂੰ ਥੋੜ੍ਹਾ ਦੱਸ ਸਕਦੇ ਹੋ ਕਿ ਉਹ ਸੈਲਰੀ ਪੈਕਜ ਦਾ ਕੀ ਹਿਸਾਬ ਕਿਤਾਬ ਹੈਗਾ ਸੀ ਹਾਂਜੀ ਸਰ ਪੰਜ ਲੱਖ ਸਰ ਉਹ ਪੰਜ ਲੱਖ ਦਾ ਪੂਰਾ ਮਤਲਬ ਸਾਲ ਦਾ ਪੈਕੇਜ ਹੈ ਅੱਛਾ ਅਤੇ ਸਰ ਇਹਦੇ ਵਿੱਚ ਮਤਲਬ ਕਿ ਸਾਨੂੰ ਇਹ ਜਿਹੜੀ ਸੈਲਰੀ ਪੈਕਜ ਹੈ ਮਤਲਬ ਸਾਲ ਬਾਅਦ ਮਤਲਬ ਮਿਲੇਗੀ ਜਾਂ ਮੰਥਲੀ ਮੰਥਲੀ ਦਾ ਸਿਸਟਮ ਹੁੰਦਾ ਇਹਦੇ ਵਿੱਚ ਅਤੇ ਮੰਥਲੀ ਅੱਛਾ ਠੀਕ ਹੈ ਸਰ ਓਕੇ ਸਰ ਥੈਂਕ ਯੂ ਸਰ ਧੰਨਵਾਦ ਸਰ